ਸਿੱਖਿਆ ਰੁਜ਼ਗਾਰ ਅਤੇ ਸਮਾਜਿਕ ਸਥਿਤੀ ਦੇ ਰੂਪ ਵਿੱਚ ਲੁਧਿਆਣੇ ਜ਼ਿਲ੍ਹੇ ਦੀਆਂ ਔਰਤਾਂ ਨੂੰ ਬਹੁਤ ਸਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹਨ ਸਭ ਤੋਂ ਪਹਿਲਾਂ ਤਾਂ ਉਹਨਾਂ ਔਰਤਾਂ ਉੱਤੇ ਬਹੁਤ ਸਾਰੀ ਜ਼ਿੰਮੇਵਾਰੀਆਂ ਹੁੰਦੀਆਂ ਹਨ ਜਿਹੜੀ ਕਿ ਨੌਕਰੀਆਂ ਕਰਦੀ ਹਨ ਜਿਹੜੀ ਕਿ ਰੁਜ਼ਗਾਰ ਕਰਦੀਆਂ ਹਨ ਜਿਹਨਾਂ ਕੋਲ ਰੁਜ਼ਗਾਰ ਹੈ ਉਹ ਪਹਿਲਾਂ ਸਵੇਰੇ ਉੱਠ ਕੇ ਆਪਣੇ ਘਰਦਿਆਂ ਦਾ ਖਾਣਾ ਬਣਾਉਂਦੀ ਹਨ ਘਰਦਿਆਂ ਦੀ ਸਾਰੀ ਜ਼ਿੰਮੇਵਾਰੀ ਨੂੰ ਪੂਰਾ ਕਰਦੀ ਹੈ ਅਤੇ ਆਪਣੇ ਨੌਕਰੀ 'ਤੇ ਜਾਂਦੀ ਹੈ ਅਤੇ ਆਪਣੀ ਨੌਕਰੀ ਦੀ ਜ਼ਿੰਮੇਵਾਰੀ ਵੀ ਪੂਰੀ ਕਰਦੀ ਹਨ ਜਦੋਂ ਕਿ ਜਿਹੜੇ ਕਿ ਮਰਦ ਲੋਕ ਹਨ ਉਹ ਉਹੀਨਾਂ ਉੱਤੇ ਇੰਨੀ ਜ਼ਿੰਮੇਵਾਰੀ ਨਹੀਂ ਹੁੰਦੀ ਉਹ ਸਿਰਫ਼ ਆਪਣੀ ਨੌਕਰੀ ਅਤੇ ਰੁਜ਼ਗਾਰ ਦਾ ਕੰਮ ਕਰਦੇ ਹਨ ਲੇਕਿਨ ਜਿਹੜੀ ਔਰਤਾਂ ਹਨ ਉਹਨਾਂ ਉੱਤੇ ਘਰ ਅਤੇ ਨੌਕਰੀ ਦੋਨਾਂ ਦੀਆਂ ਜ਼ਿੰਮੇਵਾਰੀਆਂ ਦਾ ਬੋਝ ਹੁੰਦਾ ਹੈ ਅਤੇ ਉਹਨਾਂ ਦਾ ਪੂਰਾ ਦਿਨ ਇਨ ਇਸ ਇਨ ਇਹ ਹੀ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਨਿਕਲ ਜਾਂਦਾ ਹੈ ਉਹਨਾਂ ਨੂੰ ਬੱਚਿਆਂ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਅਤੇ ਆਪਣਾ ਕੰਮ ਵੀ ਸਾਰਾ ਪੂਰਾ ਕਰਨਾ ਪੈਂਦਾ ਹੈ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਲੁਧਿਆਣੇ ਦੀਆਂ ਔਰਤਾਂ ਹਰ ਹਰ ਪਾਸੇ ਬਹੁਤ ਹੀ ਮਿਹਨਤ ਨਾਲ ਅਤੇ ਲਗਨ ਨਾਲ ਕੰਮ ਕਰਦੀਆਂ ਪਈਆਂ ਹਨ ਅਤੇ ਆਪਣੇ ਘਰ ਵਾਸਤੇ ਅਤੇ ਆਪਣੀ ਨੌਕਰੀ ਵਾਸਤੇ ਪੂਰੀ ਮਿਹਨਤ ਕਰਦੀਆਂ ਹਨ